ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਵਿੱਚ ਕਈ ਮੰਦਰ ਗੁਰਦੁਆਰੇ ਚਰਚ ਮਸੀਤਾਂ ਹਨ ਪੰਜਾਬ ਵਿੱਚ ਗੁਰਦੁਆਰਿਆਂ ਦੀ ਸੰਖਿਆ ਜ਼ਿਆਦਾ ਹੈ ਜਿਸ ਵਿੱਚ ਸਿੱਖਾਂ ਦੀ ਗਿਣਤੀ ਵੀ ਜ਼ਿਆਦਾ ਹੈ ਪੰਜਾਬ ਵਿੱਚ ਮੁੱਖ ਸਥਾਨ ਗੁਰੂ ਦਰਬਾਰ ਸਾਹਿਬ ਜੀ ਹੈ ਜਿਹੜਾ ਅੰਮ੍ਰਿਤਸਰ ਵਿੱਚ ਸਥਿਤ ਹੈ ਪੰਜਾਬ ਵਿੱਚ ਲੱਖਾਂ ਸ਼ਰਧਾਲੂ ਪੰਜਾਬ ਅਤੇ ਹੋਰ ਸਟੇਟਾਂ ਵਿਦੇਸ਼ਾਂ ਵਿੱਚ ਲੱਖਾਂ ਸ਼ਰਧਾਲੂ ਇੱਥੇ ਪੂਜਦੇ ਹਨ ਪੰਜਾਬ ਵਿੱਚ ਗੁਰਦੁਆਰਿਆਂ ਦੇ ਵਿੱਚ ਇਸ ਨੂੰ ਪ੍ਰਮੁੱਖ ਸਥਾਨ ਮੰਨਿਆ ਜਾਂਦਾ ਹੈ ਹੋਰ ਵੀ ਬਹੁਤ ਗੁਰਦੁਆਰੇ ਹਨ ਪਰ ਇਸ ਦੀ ਮਹਾਨਤਾ ਕੁਛ ਜ਼ਿਆਦਾ ਹੈ ਪੰਜਾਬ ਵਿੱਚ ਗੁਰਦੁਆਰੇ ਹੋਣ ਕਾਰਨ ਗੁਰਪੁਰਬ ਇਹਨਾਂ ਦਾ ਮੁੱਖ ਤਿਉਹਾਰ ਹੁੰਦਾ ਹੈ ਗੁਰਪੁਰਬ ਗੁਰੂਆਂ ਦੀ ਦੇਣ ਹੈ ਗੁਰਪੁਰਬ ਵਾਲੇ ਦਿਨ ਇਸ ਵਿੱਚ ਲੋਕ ਲੰ ਲੱਖਾਂ ਨੂੰ ਲੰਗਰ ਛਕਾਉਂਦੇ ਹਨ ਇਸ ਵਿੱਚ ਇਸ ਗੁਰਬਾਣੀ ਪੜ੍ਹੀ ਜਾਂਦੀ ਹੈ ਅਤੇ ਇਸ ਨਾਲ ਧਰਮ ਦੀ ਸਥਾਪਨਾ ਹੁੰਦੀ ਹੈ ਜਿਸ ਰਾਹੀਂ ਪੰਜਾਬ ਵਿੱਚ ਗੁਰਦੁਆਰਿਆਂ ਨੂੰ ਜ਼ਿਆਦਾ ਮ ਮਾਨਤਾ ਮਿਲੀ ਜਾਂਦੀ ਹੈ